ਸਤਿ ਸ਼੍ਰੀ ਅਕਾਲ ਜੀ ਮੈਂ ਮੀਸ਼ੋ ਤੋਂ ਇੱਕ ਆਡਰ ਮ ਕੀਤਾ ਸੀਗਾ ਔਰ ਡਿਲੀਵਰੀ ਕਾਫ਼ੀ ਲੇਟ ਪਹੁੰਚੀ ਜੀ ਔਰ ਜਿਹੜੀ ਕਿ ਹੈ ਇੱਕ ਹਫ਼ਤਾ ਪਹਿਲਾਂ ਆ ਜਾਣੀ ਚਾਹੀਦੀ ਸੀ ਔਰ ਪੈਕੇਜ ਵੀ ਬਹੁਤ ਘਟੀਆ ਸੀਗਾ ਜਦ ਮੈਂ ਪੈਕੇਜ ਖੋਲ੍ਹ ਕੇ ਦੇਖਿਆ ਤਾਂ ਵਿੱਚੋਂ ਕੋਈ ਹੋਰ ਰੰਗ ਨਿਕਲ ਗਿਆ ਮੈਂ ਲਾਲ ਰੰਗ ਮਗਵਾਇਆ ਸੀਗਾ ਕਿਸੇ ਹੋਰ ਰੰਗ ਔਰ ਸਾਈਜ਼ ਵੀ ਉਸਦਾ ਹੋਰ ਸੀਗਾ ਮੈਂ ਮੀਡੀਅਮ ਸਾਈਜ਼ ਮੰਗਾਇਆ ਸੀਗਾ ਵਿੱਚੋਂ ਲਾਰਜ ਸਾਈਜ਼ ਨਿਕਲਿਆ ਰੇਟ ਵੀ ਬਹੁਤ ਜ਼ਿਆਦਾ ਸੀਗਾ ਉਸਦਾ ਔਰ ਤੁਹਾਡਾ ਡਿਲੀਵਰੀ ਬੋਆਏ ਬਹੁਤ ਬਤਮੀਜ਼ੀ ਨਾਲ ਗੱਲ ਕਰ ਰਿਹਾ ਸੀਗਾ ਜਿਸ ਕਰਕੇ ਮੈਨੂੰ ਬਹੁਤ ਬੁਰਾ ਲੱਗਿਆ ਔਰ ਮੈਂ ਅੱਗੇ ਤੋਂ ਤੁਹਾਡੇ ਮੀਸ਼ੋ ਤੋਂ ਕੋਈ ਵੀ ਚੀਜ਼ ਆਡਰ ਨਹੀਂ ਕਰਾਗਾਂ